ਅੱਜ ਮੈਂ ਤੁਹਾਡੇ ਨਾਲ ਆਪਣਾ ਕੁਕਿੰਗ ਦਾ ਤਜਰਬਾ ਸਾਂਝਾ ਕਰਨ ਲੱਗੀ ਹਾਂ ਮੈਨੂੰ ਕੁਕਿੰਗ ਕਰਨ ਦਾ ਸ਼ੌਂਕ ਬਚਪਨ ਤੋਂ ਹੀ ਸੀ ਜਦੋਂ ਵੀ ਮੇਰੀ ਮਾਂ ਰਸੋਈ 'ਚ ਜਾਂਦੀ ਸੀ ਤਾਂ ਮੈਂ ਉਹਨਾਂ ਦੇ ਮਗਰ ਮਗਰ ਚਲੀ ਜਾਂਦੀ ਸੀ ਅਤੇ ਦੇਖਦੀ ਸੀ ਕਿ ਉਹ ਕਿੱਦਾਂ ਸਬਜ਼ੀਆਂ ਬਣਾ ਰਹੇ ਹਨ ਉੱਥੋਂ ਮੈਨੂੰ ਲੱਗਦਾ ਹੈ ਕਿ ਮੈਨੂੰ ਮੇਰੀ ਮਾਂ ਤੋਂ ਹੀ ਇਹ ਸ਼ੌਂਕ ਮਿਲਿਆ ਹੈ ਕਿਉਂਕਿ ਉਹਨਾਂ ਨੂੰ ਵੀ ਇਹ ਕੁਕਿੰਗ ਕਰਨਾ ਬਹੁਤ ਪਸੰਦ ਹੈ ਅਤੇ ਉਹਨਾਂ ਦੇ ਹੱਥ ਦੀ ਰੋਟੀ ਦਾ ਰੋਟੀ ਦੀ ਰੀਸ ਕੋਈ ਨਹੀਂ ਉਹਨਾਂ ਦੇ ਹੱਥ ਵਿੱਚ ਤਾਂ ਇੱਦਾਂ ਲੱਗਦਾ ਹੈ ਜਿੱਦਾਂ ਕੋਈ ਜਾਦੂ ਹੈ ਅਤੇ ਕੋਈ ਜਾਦੂਗਰ ਮਸਾਲਾ ਪਾ ਦਿੰਦੇ ਹਨ ਅਤੇ ਸਬਜ਼ੀ ਨੂੰ ਸਵਾਦਿਸ਼ਟ ਬਣਾ ਦਿੰਦੇ ਹਨ ਜਦੋਂ ਪਹਿਲੀ ਵਾਰ ਮੈਂ ਕਿਤ ਰਸੋਈ 'ਚ ਗਈ ਤਾਂ ਸਭ ਤੋਂ ਪਹਿਲਾਂ ਮੈਂ ਮੈਨੂੰ ਮੇਰੀ ਮਾਂ ਨੇ ਰਾਜਮਾਂਹ ਬਣਾਉਣ ਲਈ ਕਿਹਾ ਸੀ ਮੈਨੂੰ ਮੰਮੀ ਨੇ ਦੱਸ ਦਿੱਤਾ ਕਿ ਕੀ ਕੀ ਪੈਣਾ ਹੈ ਸਬਜ਼ੀਆਂ 'ਚ ਰਾਜਮੇ 'ਚ ਕੀ ਰਾਜਮਾਂਹ 'ਚ ਕੀ ਕੀ ਪੈਣਾ ਹੈ ਅਤੇ ਮੈਂ ਉੱਦਾਂ ਹੀ ਕਰਨ ਲੱਗ ਪਈ ਚੱਲੋ ਮੈਂ ਹੁਣ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਦੀ ਹਾਂ ਕਿ ਜਦੋਂ ਮੈਂ ਰਾਜਮਾਂਹ ਬਣਾਏ ਤਾਂ ਮੈਨੂੰ ਕਿੱਦਾਂ ਦਾ ਲੱਗਿਆ ਜਦੋਂ ਮੈਂ ਪਹਿਲੀ ਵਾਰ ਰਾਜਮਾਂਹ ਬਣਾਉਣ ਲੱਗੀ ਮੈਂ ਤਾਂ ਬਹੁਤ ਪਹਿਲਾਂ ਤਾਂ ਮੈਂ ਬਹੁਤ ਨਰਵਸ ਸੀ ਮੈਨੂੰ ਪਿਆਜ ਕੱਟਣਾ ਬਹੁਤ ਮੈਨੂੰ ਪਿਆਜ ਕੱਟਣਾ ਪਸੰਦ ਨਹੀਂ ਸੀ ਪਰ ਮੈਂ ਤਾਂ ਵੀ ਕੱਟ ਹੀ ਲਏ ਪਿਆਜ ਕੱਟਦੇ ਕੱਟਦੇ ਮੇਰੀ ਅੱਖਾਂ ਵਿੱਚ ਅੱਥਰੂ ਆ ਗਏ ਅਤੇ ਮੈਨੂੰ ਲੱਗ ਰਿਹਾ ਸੀ ਮੈਂ ਕਿਉਂ ਰੋ ਰਹੀ ਹਾਂ ਉਦੋਂ ਮੇਰੀ ਉਮਰ ਤਕਰੀਬਨ ਬਾਰਾਂ ਤੇਰਾਂ ਸਾਲ ਸੀ ਫਿਰ ਜਦੋਂ ਮੈਂ ਪਿਆਜ ਕੱਟ ਲਏ ਤੇਲ ਤੇਲ ਪੱਕ ਗਿਆ ਉਸ ਵਿੱਚ ਮੈਂ ਪਿਆਜ ਦਾ ਤੜਕਾ ਪਾਇਆ ਫਿਰ ਟਮਾਟਰ ਅਤੇ ਹੋਰ ਮਸਾਲੇ ਨਾਲ ਨਮਕ ਮਿਰਚ ਪਾਇਆ ਮੇਰਾ ਜਦੋਂ ਮੈਂ ਪਿਆਜ ਤ ਪਿਆਜ 'ਚ ਪਾਤਾ ਸਾਰਾ ਮੇਰਾ ਮਸਾਲਾ ਹੋ ਗਿਆ ਤਾਂ ਭੁਨ ਮਸਾਲਾ ਭੁਜ ਕੇ ਤਿਆਰ ਹੋ ਗਿਆ ਤਾਂ ਫਿਰ ਮੈਂ ਉਸ ਵਿੱਚ ਰਾਜਮਾਂਹ ਦੇ ਦਾਣੇ ਪਾਏ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਕਰ ਉਸ ਵਿੱਚ ਰਾਜਮਾਂਹ ਦਾ ਪਾਣੀ ਪਾ ਦਿੱਤਾ ਅਤੇ ਥੋੜ੍ਹੀ ਦੇਰ ਗੜਕਾ ਦਿੱਤਾ ਗੜਕਾਉਣ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਕਿਹਾ ਕਿ ਇਸ ਚੱਖੋ ਕਿ ਇਹ ਕਿੱਦਾਂ ਦੇ ਬਣੇ ਹਨ ਇਸਦਾ ਨਮਕ ਮਿਰਚ ਠੀਕ ਹੈ ਜਾਂ ਨਹੀਂ ਮੇਰੀ ਮਾਂ ਨੇ ਮੈਨੂੰ ਕਿਹਾ ਅੱਜ ਮੈਂ ਨਹੀਂ ਚੱਖਣਾ ਅੱਜ ਤੁਸੀਂ ਆਪੇ ਚੱਖੋ ਮੈਂ ਬਹੁਤ ਹੀ ਡਰੀ ਹੋਈ ਸੀ ਕਿ ਅਗ ਜੇ ਨਮਕ ਘੱਟ ਜਾਂ ਵੱਧ ਹੋ ਜ ਹੋ ਗਿਆ ਤਾਂ ਮੈਨੂੰ ਘਰ ਵਾਲਿਆਂ ਕੋਲੋਂ ਝਿੜਕਾਂ ਪਵੇਗੀ ਝਿੜਕਾਂ ਪੈਣਗੀਆਂ ਪਰ ਇੱਦਾਂ ਦਾ ਕੁਝ ਨਹੀਂ ਥੋੜ੍ਹਾ ਜਿਹਾ ਨਮਕ ਘੱਟ ਸੀ ਫਿਰ ਮੈਂ ਥੋੜ੍ਹਾ ਜਿਹਾ ਨਮਕ ਹੋਰ ਪਾ ਤਾ ਜਦੋਂ ਮੈਂ ਸਾਰਿਆਂ ਨੂੰ ਰੋਟੀ ਦਿੱਤੀ ਤਾਂ ਮੈਂ ਬਹੁਤ ਖੁਸ਼ ਸੀ ਅਤੇ ਆਪਣੀ ਮਾਂ ਨੂੰ ਕ ਅਤੇ ਮੈਂ ਸਾਰਿਆਂ ਕੋਲੋਂ ਪੁੱਛ ਰਹੀ ਸੀ ਕਿ ਕਿੱਦਾਂ ਦੇ ਬਣੇ ਹੈ ਗੈਸ ਕਰੋ ਕਿ ਅੱਜ ਰੋਟੀ ਕਿਨ ਬਣਾਈ ਹੈ ਤਾਂ ਸਾਰੇ ਕਹਿ ਰਹੇ ਸਨ ਮਜ਼ਾਕ ਨਾਲ ਕਿ ਰੋਟੀ ਤਾਂ ਬਹੁਤ ਸੁਆਦ ਹੈ ਰੋਟੀ ਤਾਂ ਬਹੁਤ ਸੁਆਦ ਹੈ ਇਹ ਤਾਂ ਕਿਸੇ ਸ਼ੈਫ ਨੇ ਬਣਾਈ ਹੈ ਤਾਂ ਫਿਰ ਮੈਂ ਉਹਨਾਂ ਨੂੰ ਖੁਸ਼ੀ ਨਾਲ ਕਿਹਾ ਕਿ ਇਹ ਰੋਟੀ ਮੈਂ ਬਣਾਈ ਹੈ ਰਾਜਮਾਂਹ ਮੈਂ ਬਣਾਏ ਆ ਅੱਜ ਤਾਂ ਫਿਰ ਉਹਨਾਂ ਨੇ ਮੇਰੇ ਪਿਤਾ ਜੀ ਨੇ ਮੈਨੂੰ ਸੌ ਰੁਪਇਆ ਇਨਾਮ ਵਜੋਂ ਦਿੱਤਾ ਅਤੇ ਮੇਰੀ ਦਾਦੀ ਨੇ ਵੀ ਮੇਰੀ ਬਹੁਤ ਪ੍ਰਸ਼ੰਸਾ ਕੀਤੀ ਇਹ ਸੀ ਮੇਰਾ ਤੁਸ ਕੁਕਿੰਗ ਦਾ ਤਜਰਬਾ ਧੰਨਵਾਦ